ਮੈਂ ਆਪਣੇ ਪਰਿਵਾਰ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗਈ ਸੀ ਉੱਥੇ ਗੁਰਦੁਆਰੇ ਦਾ ਦਿਲ ਖਿੱਚਵਾਂ ਦ੍ਰਿਸ਼ ਮੈਨੂੰ ਬਹੁਤ ਯਾਦ ਆਉਂਦੀ ਹੈ ਉੱਥੇ ਹਰ ਪ੍ਰਦੇਸ਼ ਅਤੇ ਹਰ ਧਰਮ ਦੇ ਲੋਕ ਕਿਸੇ ਬੜੀ ਨਿਮਰਤਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਲਈ ਲਾਈਨ ਵਿੱਚ ਲੱਗੇ ਹੋਏ ਸੀ ਅਤੇ ਦਰਸ਼ਨ ਕਰਨ ਤੋਂ ਬਾਅਦ ਗੁਰੂ ਕਾ ਲੰਗਰ ਛਕਿਆ ਉੱਥੇ ਲੰਗਰ ਵੀ ਸੰਗਤ ਛੱਕ ਰਹੀ ਅਤੇ ਸੇਵਾਦਾਰ ਸੇਵਾ ਕਰ ਰਹੇ ਸੀ ਬਾਣੀ ਦਾ ਪਾਠ ਚੱਲ ਰਿਹਾ ਸੀ ਅਤੇ ਅਸੀਂ ਬਹੁਤ ਮ ਆਨੰਦ ਮਾਣਿਆ ਅਤੇ ਇਸ ਖਾਤਰ ਇਸ ਯਾਤਰਾ ਦਾ ਅਨੁਭਵ ਮੇਰੇ ਜੀਵਨ ਵਿੱਚ ਬਹੁਤ ਜ਼ਿਆਦਾ ਹੈ